ਹਾਂ ਅੱਜ ਦੀ ਇਹ ਜਿਹੜੀ ਆ ਬਹੁਤ ਵੱਡੀਆਂ ਟੈਕਨੋਲੋਜੀ ਦੇ ਨਾਲ ਤਬਦੀਲੀਆਂ ਆਈਆਂ ਉਹ ਸਾਡੇ ਜੀਵਨ ਵਿੱਚ ਜ਼ਰੀਆ ਹੋਈਆਂ ਸਭ ਤੋਂ ਪਹਿਲਾਂ ਉਹ ਮੋਬਾਈਲ ਵਗੈਰਾ ਹੋਏ ਪਹਿਲਾਂ ਮੋਬਾਈਲ ਨਹੀਂ ਹੈਗੇ ਸੀ ਬਟਣਾ ਵਾਲੇ ਮੋਬਾਈਲ ਚਲਦੇ ਸੀ ਫਿਰ ਉਸ ਤੋਂ ਬਾਅਦ ਹੈ ਟੱਚ ਸਕਰੀਨ ਵਾਲੇ ਆਏ ਅਤੇ ਉਸ ਤੋਂ ਬਾਅਦ ਜਿਹੜੇ ਕੋਵਿਡ ਦੇ ਦੌਰਾਨ ਔਨਲਾਈਨ ਕੰਮ ਕਾਫ਼ੀ ਮਸ਼ਹੂਰ ਹੋਇਆ ਜਿਹਨੇ ਕਿ ਲੋਕਾਂ ਦੇ ਕਈ ਆ ਜਿਹੜੇ ਵਿਚਾਰੇ ਉੱਥੇ ਜਾ ਨਹੀਂ ਸਕਦੇ ਸੀ ਸਕੂਲਾਂ ਚੋਂ ਉੱਥੇ ਜਾ ਕੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਈ ਅਨੁਮਤੀ ਨਹੀਂ ਹੈਗੀ ਸੀ ਤਾਂ ਉਹਨਾਂ ਨੇ ਔਨਲਾਈਨ ਕਲਾਸਾਂ ਲੈ ਕੇ ਆਪਣੀ ਜ਼ਿੰਦਗੀ ਬਚਾਈ ਨਹੀਂ ਅਤੇ ਕੰਮ ਉੱਥੇ ਉਸ ਵੇਲੇ ਤਾਂ ਬੜੇ ਹੀ ਠੱਪ ਹੋ ਚੁੱਕੇ ਸੀ ਪਰ ਇਸ ਟਾਈਮ ਦੇ ਵਿੱਚ ਔਨਲਾਈਨ ਜਿਹੜੇ ਕੰਮ ਹੋਏ ਉਹਨਾਂ ਨੇ ਕਾਫ਼ੀ ਲੋਕਾਂ ਨੂੰ ਬਚਾਈ ਵੀ ਰੱਖਿਆ ਇਹ ਤਬਦੀਲੀਆਂ ਨੇ ਸਾਡੇ ਦੇ ਜੀਵਨ ਵਿੱਚ ਤਾਂ ਕਾਫ਼ੀ ਪ੍ਰਭਾਵਿਤ ਕੀਤਾ ਸਾਡੇ ਕੰਮ ਵਾਲੀ ਮ ਮਤਲਬ ਕਿ ਜਗ੍ਹਾ ਜਾਣੀ ਸਕੂਲ ਵਗੈਰਾ ਕੀ ਬੱਚੇ ਘਰ ਬੈਠੇ ਪੜ੍ਹ ਸਕਦੇ ਸੀ ਤੁਹਾਨੂੰ ਦੇਖ ਸਕਦੇ ਸੀ ਅਤੇ ਉਹਦੇ ਨਾਲ ਵੀ ਕਾਫੀ ਇੰਪਰੂਵਮੈਂਟ ਹੋਈ ਫਿਰ ਉਸ ਤੋਂ ਬਾਅਦ ਇਹ ਵਾਸ਼ਿੰਗ ਮਸ਼ੀਨਾਂ ਅੱਜ ਕੱਲ੍ਹ ਜਿਹੜੀਆਂ ਹੈਗੀਆ ਹੈ ਕਿ ਕੱਪੜੇ ਪ੍ਰੈਸ ਕਰਕੇ ਨਿਕਲ ਆਉਂਦੇ ਹੈ ਤੁਸੀਂ ਬੱਸ ਸਿਰਫ ਪਾਣੇ ਹੀ ਹੈ ਅਤੇ ਫਿਰ ਉਸ ਤੋਂ ਬਾਅਦ ਕਾਰਾਂ ਨੇ ਤੁਹਾਡੀ ਜ਼ਿੰਦਗੀ ਕਾਫ਼ੀ ਸੌਖੀ ਕਰ ਦਿੱਤੀ ਕਾਫ਼ੀ ਤਬਦੀਲੀਆਂ ਆਈਆਂ ਜਿੰਨਾ ਕਿ ਸਾਡੀ ਜ਼ਿੰਦਗੀ ਵਿੱਚ ਕਾਫ਼ੀ ਸੌਖਾ ਜੀਵਨ ਸਾਡਾ ਕ ਕੀਤਾ ਹੈ ਅਤੇ ਸਾਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਕਿ ਅਸੀਂ ਥੋੜ੍ਹੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਗੁਜ਼ਾਰ ਸਕੀਏ ਨਹੀਂ ਤਾਂ ਜਿਸ ਤਰ੍ਹਾਂ ਸਰਦੀ ਆਉਂਦੀ ਸੀ ਉਹ ਸਭ ਵਾਸ਼ਿੰਗ ਮਸ਼ੀਨ 'ਚ ਕੱਪੜੇ ਸੁੱਕ ਜਾਂਦੇ ਹੈ ਨਹੀਂ ਤਾਂ ਕੱਪੜੇ ਹੀ ਸੁਕਾਉਣੇ ਬੜੇ ਮੁਸ਼ਕਿਲ ਆ ਕਿਉਂਕਿ ਸੂਰਜ ਦੇਵਤਾ ਹੀ ਨਹੀਂ ਦਰਸ਼ਨ ਦਿੰਦੇ ਅਤੇ ਉਹਨਾਂ ਦੇ ਕਰਕੇ ਕਿੰਨੀ ਮੁਸ਼ਕਿਲ ਹੋ ਜਾਂਦੀ ਅਤੇ ਸਾਨੂੰ ਹੁਣ ਕਾਫ਼ੀ ਤਬਦੀਲੀ ਆਈ ਹੈ ਜਿਹਦੇ ਨਾਲ ਸਾਡੀ ਕਾਫ਼ੀ ਤਰੱਕੀ ਹੋਈ ਹੈ